ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਓ ਪੀ ਜਿਊਲਰ ਤੋਂ ਗੱਲ ਕਰ ਰਹੇ ਹੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਨਾ ਤੁਹਾਡੇ ਤੋਂ ਨਾ ਅਜੇ ਸੋਨੇ ਦੇ ਨਾ ਕੁਝ ਗਹਿਣੇ ਜਿਹੜੇ ਪਿਛਲੇ ਸਾਲ ਆਪਣੇ ਭਰਾ ਦੇ ਵਿਆਹ 'ਤੇ ਬਣਵਾਏ ਸੀਗੇ ਅਤੇ ਹੁਣ ਨਾ ਆਉਣ ਵਾਲੇ ਦੋ ਤਿੰਨ ਮਹੀਨਿਆਂ ਦੇ ਵਿੱਚ ਮੇਰੀ ਭੈਣ ਦਾ ਵਿਆਹ ਆ ਰਿਹਾ ਅਤੇ ਮੈਂ ਦੁਬਾਰਾ ਤੋਂ ਨਾ ਉਹੀ ਸੋਨੇ ਦੇ ਗਹਿਣੇ ਸਾਰੇ ਬਣਵਾਉਣੇ ਸੀਗੇ ਤੁਹਾਡੇ ਤੋਂ ਹਾਂਜੀ ਸਰ ਪਿਛਲੀ ਵਾਰ ਬਹੁਤ ਹੀ ਸਾਰੇ ਹੀ ਜਿਹੜੇ ਤੁਹਾਡੇ ਡਿਜ਼ਾਇਨ ਸੀਗੇ ਸਭ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਏ ਅਤੇ ਮੈਂ ਸੋਚਿਆ ਵੀ ਸਾਨੂੰ ਦੁਬਾਰਾ ਤੋਂ ਉੱਥੋਂ ਹੀ ਲੈਣਾ ਚਾਹੀਦਾ ਅਤੇ ਮੈਨੂੰ ਤੁਸੀਂ ਦੱਸੋਗੇ ਜੀ ਕਿ ਸੋਨੇ ਦਾ ਰੇਟ ਕੀ ਚੱਲ ਰਿਹਾ ਠੀਕ ਹੈ ਜੀ ਹਾਂਜੀ ਹਾਂਜੀ ਮੈਂ ਜੀ ਦਸ ਤੋਂ ਪੰਦਰਾਂ ਕੁ ਤੋਲੇ ਜਿਹੜੇ ਹੈਗੇ ਸੋਚ ਰਹੀ ਸੀ ਜਿਹਦੇ ਵਿੱਚ ਹਾਰ ਵਾਲਾ ਦੋ ਸੈਟ ਹੋ ਜਾਣ ਦੋ ਕੜੇ ਬਣ ਜਾਣ ਚੂੜੀਆਂ ਬਣ ਜਾਣ ਰਿੰਗ ਬਣ ਜਾਵੇ ਜੇ ਕੁਝ ਘਾਟਾ ਵਾਧਾ ਹੋਵੇ ਉਹ ਅਸੀਂ ਕਰ ਲਵਾਂਗੇ ਬਟ ਇਹ ਹੈ ਵੀ ਜੇ ਤੁਸੀਂ ਮੈਨੂੰ ਔਨਲਾਈਨ ਜੇ ਕੋਈ ਤੁਹਾਡੇ ਕੋਈ ਆਪਣੇ ਕੋਈ ਤੁਹਾਡੇ ਜਿਹੜੇ ਕਾਰੀਗਰਾਂ ਨੇ ਕੋਈ ਡਿਜ਼ਾਈਨ ਬਣਾਏ ਪਏ ਹੈ ਜੇ ਤੁਸੀਂ ਕਹੋਗੇ ਤਾਂ ਮੈਂ ਆ ਵੀ ਜਾਵਾਂਗੀ ਪਰ ਜੇ ਜੇ ਪੋਸੀਬਲ ਹੈ ਤਾਂ ਤੁਸੀਂ ਮੈਨੂੰ ਔਨਲਾਈਨ ਵੀ ਜਿਹੜਾ ਹੈਗਾ ਇਹ ਮਤਲਬ ਵਟਸਐਪ ਦੇ ਰਾਹੀਂ ਜਾਂ ਕਿਸੇ ਤਰੀਕੇ ਨਾਲ ਜੇ ਮੈਨੂੰ ਭੇਜ ਦੇਵੋਗੇ ਤਾਂ ਮੇਰੇ ਲਈ ਬੈਟਰ ਰਹੇਗਾ ਅੱਛਾ ਜੀ ਠੀਕ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਇਹੀ ਇਸੇ ਕਾਰਨ ਕਰਕੇ ਅਸੀਂ ਹਮੇਸ਼ਾ ਹੀ ਪਹਿਲਾਂ ਵੀ ਤੁਹਾਡੇ ਤੋਂ ਲਿੱਤੇ ਅਤੇ ਹੁਣ ਵੀ ਤੁਹਾਡੇ ਤੋਂ ਹੀ ਕੋਸ਼ਿਸ਼ ਹੈਗੀ ਲੈਣ ਜੀ ਚਲੋ ਠੀਕ ਹੈ ਜੀ ਮੈਨੂੰ ਤੁਸੀਂ ਭੇਜ ਦੇਣਾ ਡਿਜ਼ਾਇਨ ਟਾਈਮ 'ਤੇ ਅਤੇ ਫਿਰ ਮੈਂ ਅੱਗੇ ਉਹ ਆਪਣੀ ਫੈਮਲੀ ਨੂੰ ਸਾਰਿਆਂ ਨੂੰ ਘਰ ਦੇ ਮੈਂਬਰਾਂ ਨੂੰ ਸਭ ਨੂੰ ਦਿਖਾ ਕੇ ਫਿਰ ਤੁਹਾਡੇ ਕੋਲ ਜ਼ਰੂਰੀ ਜਿਹੜਾ ਹੀ ਨੇੜੇ ਐਤਵਾਰ ਆਏਗਾ ਉਹਦੇ 'ਚ ਮੈਂ ਤੁਹਾਡੇ ਕੋਲ ਆ ਵੀ ਜਾਵਾਂਗੀ ਅਤੇ ਆ ਕੇ ਵੀ ਦੇਖ ਲਵਾਂਗੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ